ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਮੋਹਾਲੀ ਤੋਂ ਬੋਲਦੇ ਭਾਅ ਜੀ ਮੈਂ ਨਾ ਬਾਹਰੋਂ ਆਇਆ ਸੀ ਆਪਣਾ ਇੱਥੇ ਮੋਹਾਲੀ ਏਅਰਪੋਰਟ 'ਤੇ ਖੜਾ ਹਾਂ ਮੈਂ ਨਾ ਇੱਥੇ ਮੋਹਾਲੀ 'ਚ ਕੋਈ ਜਗ੍ਹਾ 'ਤੇ ਘੁੰਮਣਾ ਜੀ ਕੋਈ ਅਟ੍ਰੈਕਟਿਵ ਪੈਲੇਸ ਕਿਹੜੀ ਹੈ ਮੈਨੂੰ ਦੱਸ ਸਕਦੇ ਹੋ ਹਾਂ ਇਹ ਮੈਂ ਅਮੈਰੀਕਾ ਤੋਂ ਆਇਆ ਜੀ ਹਾਂਜੀ ਹਾਂ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਭਾਅ ਜੀ ਉਹ ਕਿੱਧਰਲੀ ਸਾਈਡ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜਿਵੇਂ ਠੀਕ ਹੈ ਜੀ ਟੈਕਸੀ ਵਗੈਰਾ ਵੀ ਹੋ ਸਕਦੀ ਟੈਕਸੀ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਠੀਕ ਹੈ ਜੀ ਠੀਕ ਹੈ ਜੀ

ਠੀਕ ਹੈ ਜੀ ਠੀਕ ਹੈ ਕੋਈ ਬਾਤ ਨਹੀਂ ਮੈਂ ਜਾਣਾ ਤਾਂ ਚਾਹੁੰਦਾ ਭਾਅ ਜੀ ਮੈਂ ਪਤਾ ਕਰ ਲਵਾਂ ਪਹਿਲਾ ਵੀ ਕਿਹੜੀ ਕਿਹੜੀ ਜਗ੍ਹਾ ਮਿਲ ਜਾਂਦੀ ਹੈ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ

ਠੀਕ ਹੈ ਭਾਅ ਜੀ ਠੀਕ ਹਾਂਜੀ ਹਾਂਜੀ ਹਾਂਜੀ ਠੀਕ ਹੈ ਹੋਰ ਠੀਕ ਹੈ ਜੀ ਭਾਅ ਜੀ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਐਨ ਠੀਕ ਹੈ ਹਾਂਜੀ ਹਾਂਜੀ ਓਕੇ ਓਕੇ ਭਾਅ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਠੀਕ ਹੈ ਓਕੇ ਓਕੇ ਜੀ